ਅਸੀਂ ਸੋਕੇ ਜਾਂ ਅਤਿਅੰਤ ਮੌਸਮੀ ਹਾਲਾਤਾਂ ਦੌਰਾਨ ਆਪਣੇ ਪੌਦਿਆਂ ਦੀ ਸੰਭਾਲ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਜਿਵੇਂ ਸੋਕੇ ਦੇ ਵਿੱਚ ਆਪਾਂ ਲਗਾਤਾਰ ਸਮੇਂ ਸਮੇਂ ਦੇ ਅੰਤਰਾਲ ਮੁਤਾ ਬਰਾਬਰ ਸਮੇਂ ਦੇ ਅੰਤਰਾਲ ਨਾਲ ਅਨੁਸਾਰ ਪਾਣੀ ਪਾਉਣਾ ਫਿਰ ਜ ਉਨ੍ਹਾਂ ਦੀ ਗੁਡਾਈ ਕਰਨੀ ਗੋਡੀ ਕਰਨੀ ਅਤੇ ਖਾਦ ਵਗੈਰਾ ਪਾਉਣਾ ਦੇਸੀ ਖਾਦ ਜਾਂ ਜਿਹੜੇ ਵੀ ਹੋਰ ਖਾਦਾਂ ਵੀ ਚੱਲਦੀਆਂ ਨੇ ਪੈਸਟੀਸਾਈਟ ਜਾਂ ਉਹ ਵੀ ਪਾ ਸਕਦੇ ਹਾਂ ਅਤੇ ਜੇ ਮੌਸਮ ਠੰਡ ਦਾ ਹੈ ਜ਼ਿਆਦਾ ਸਰਦੀ ਪੈ ਰਹੀ ਹੈ ਫਿਰ ਉਹਨਾਂ ਨੂੰ ਕਿਸੇ ਪਰਾਲੀ ਨਾਲ ਕਵਰ ਕਰਨਾ ਜਾਂ ਹੋਰ ਜਿਹੜੇ ਤਰੀਕੇ ਨੇ ਤਰਪਾਲ ਵਗੈਰਾ ਪਾ ਕੇ ਜਾਂ ਅੱਜ ਕੱਲ੍ਹ ਗਰੀਨਮੈਸ਼ ਆਉਂਦੇ ਨੇ ਉਹਨਾਂ ਨੂੰ ਜੇ ਪਾ ਕੇ ਅਸੀਂ ਇਨ੍ਹਾਂ ਨੂੰ ਆਪਾਂ ਕਰ ਸਕਦੇ ਹਾਂ ਪੂਰਾ